ਹੈਲੋ ਮੇਰਾ ਨਾਮ ਨਾ ਮਹਿਕ ਆ ਮੈਨੂੰ ਔਨਲਾਈਨ ਸ਼ੋਪਿੰਗ ਕਰਨਾ ਬੜਾ ਵਧੀਆ ਲੱਗਦਾ ਸਾਡੇ ਘਰ ਨਾ ਇੱਕ ਵਿਆਹ ਦਾ ਕਾਟ ਆਇਆ ਸੀ ਮੇਰੇ ਕੋਲ ਨਾ ਬੜੀਆ ਡਰੈਸਸ ਸੀ ਬਟ ਮੇਰੇ ਕੋਲ ਨਾ ਉਹਦੇ ਨਾਲ ਦੇ ਮੈਚਿੰਗ ਏਅਰਿੰਗਸ ਨਹੀਂ ਸੀ ਅਤੇ ਮੈਂ ਸੋਚਿਆ ਮੈਂ ਔਨਲਾਈਨ ਸ਼ੋਪਿੰਗ ਤਾਂ ਕਰਦੀ ਰਹਿੰਦੀ ਹਾਂ ਐਮਾਜੋਨ ਤੋਂ ਹੀ ਜ਼ਿਆਦਾ ਕਰਦੀ ਹਾਂ ਬਾਕੀ ਐਪਸ ਤੋਂ ਘੱ ਐਪਸ ਤੋਂ ਘੱਟ ਹੀ ਕਰਦੀ ਹਾਂ ਅਤੇ ਮੈਂ ਨਾ ਸੋਚਿਆ ਕਿ ਚਲ ਐਮਾਜ਼ੋਨ 'ਤੇ ਦੇਖਦੇ ਹਾਂ ਕੀ ਪਤਾ ਇਹਦੇ ਨਾਲ ਦੇ ਮੈਚਿੰਗ ਮੈਨੂੰ ਏਅਰਿੰਗਸ ਮਿਲੀ ਹੀ ਜਾਣ ਅਤੇ ਮੈਂ ਨਾ ਦੇਖਦੀ ਪਈ ਸੀ ਮੈਂ ਸਕਰੋਲ ਕਰਦੀ ਪਈ ਸੀ ਅਤੇ ਮੈਨੂੰ ਇੱਕ ਏਅਰਿੰਗਸ ਜੋ ਕਿ ਬਹੁਤ ਪਸੰਦ ਆਏ ਅਤੇ ਮੈਂ ਸੋਚਿਆ ਕਿ ਮੈਂ ਉਹਨੂੰ ਔਡਰ ਕਰ ਲੈਦੀ ਹਾਂ ਅਤੇ ਮੈਂ ਔਡਰ ਕੀਤਾ ਅਤੇ ਉੱਥੇ ਨਾ ਡੇਟ ਲਿਖੀ ਹੋਈ ਸੀਗੀ ਥਰਟੀ ਫਸਟ ਅੱਜ ਦੀ ਡੇਟ ਲਿਖੀ ਹੋਈ ਸੀ ਥਰਟੀ ਫਸਟ ਜੈਨ ਬਟ ਮੇਰਾ ਅ ਜਿਹੜਾ ਮੈਨੂੰ ਚਾਹੀਦੇ ਸੀ ਨਾ ਉਹ ਮੈਨੂੰ ਚਾਹੀਦੇ ਸੀਗੇ ਕਿ ਵਿਆਹ ਵਾਲੇ ਦਿਨ ਮੈਂ ਪਾਉਣੇ ਸੀ ਅਤੇ ਉਹ ਵਿਆਹ ਸੀਗਾ ਟਵੈਂਟੀ ਏਟ ਨੂੰ ਤਾਂ ਮੈਂ ਸੋਚਿਆ ਕਿ ਬਾਅਦ 'ਚ ਮੈਨੂੰ ਮਿਲਣਗੇ ਤਾਂ ਮੈਨੂੰ ਕੀ ਫਾਇਦਾ ਹੋਊਗਾ ਅਤੇ ਮੈਂ ਪਾਊਂਗੀ ਵੀ ਨਹੀਂ ਮੈਂ ਪਹਿਲਾਂ ਔਡਰ ਜਿਹੜਾ ਨਾ ਉਹ ਕਰ ਕੈਂਸਲ ਕਰਨ ਲੱਗੀ ਸੀਗੀ ਬਟ ਫਿਰ ਮੈਂ ਕਿਹਾ ਚੱਲ ਮੰਗਵਾ ਹੀ ਲੈਂਦੇ ਹਾਂ ਫਿਰ ਜਦੋਂ ਪ੍ਰੋਡਕਟ ਆਇਆ ਘਰ ਮੈਂ ਦੇਖਿਆ ਬਹੁਤ ਅੱਛੇ ਏਅਰਿੰਗ ਸੀ ਪੂਰੇ ਮੇਰੇ ਡਰੈਸ ਦੇ ਨਾਲ ਮੈਚ ਹੋ ਰਹੇ ਸੀ ਫਿਰ ਜਿਸ ਦਿਨ ਸ਼ਾਦੀ ਸੀ ਜਿਹੜਾ ਵਿਆਹ ਆਇਆ ਸੀ ਸਾਨੂੰ ਮੈਂ ਉੱਥੇ ਪਾਏ ਬਹੁਤ ਜ਼ਿਆਦਾ ਲਾਈਟ ਵੇਟ ਸੀ ਉਹ ਦੇਖਣ ਨੂੰ ਬੜੇ ਹੈਵੀ ਲੱਗਦੇ ਸੀਗੇ ਬਟ ਉਹ ਬਹੁਤ ਲਾਈਟ ਵੇਟ ਸੀ ਮੇਰੇ ਕੰਨ ਵੀ ਨਹੀਂ ਦਰਦ ਕੀਤੇ ਨਹੀਂ ਤਾਂ ਆਪਾਂ ਪਾਉਂਦੇ ਹਾਂ ਨਾ ਦੂਸਰੇ ਏਅਰਿੰਗਸ ਤਾਂ ਕੰਨ ਬਹੁਤ ਦਰਦ ਕਰਦੇ ਆ ਅਤੇ ਉਹਦੇ ਨਾਲ ਮੇਰੇ ਕੰਨ ਵੀ ਨਹੀਂ ਦਰਦ ਕੀਤੇ ਬੜੇ ਲਾਈਟ ਵੇਟ ਸੀ ਅਤੇ ਸਾਰਿਆਂ ਨੂੰ ਬਹੁਤ ਪਸੰਦ ਆਏ ਮੇਰੇ ਏਅਰਿੰਗਸ ਉਹਦੇ ਜਿਹੜੇ ਵਿੱਚ ਨਗ ਲੱਗੇ ਹੋਏ ਸੀ ਇੱਕ ਜਿਹੜੇ ਆਪਾਂ ਬਾਜ਼ਾਰੋਂ ਲੈਂਦੇ ਹਾਂ ਉਹ ਤਾਂ ਖ਼ਤਮ ਮੁਕ ਉਹ ਹੋ ਜਾਂਦੇ ਆ ਟੁ ਅ ਨਿਕਲ ਜਾਂਦੇ ਆ ਬਟ ਉਹਦੇ ਨਹੀਂ ਨਿਕਲੇ ਉਹ ਬਹੁਤ ਅੱਛੇ ਰਹੇ ਏਅਰਿੰਗਸ ਵੀ ਉਹਦੇ ਅਤੇ ਥੈਂਕ ਯੂ ਕਰਦੀ ਹਾਂ ਮੈਂ ਐਮਾਜੋਨ ਦਾ ਕਿ ਉਹਨਾਂ ਨੇ ਮੈਨੂੰ ਇੰਨਾ ਵਧੀਆ ਅੱਛਾ ਪ੍ਰੋਡਕਟ ਦਿੱਤਾ ਥੈਂਕਫੁਲ